ਪੰਜਾਬ ਵਿੱਚ ਵਪਾਰਕ ਖੇਤਰ ਜਾਨੀ ਕਿ ਵਪਾਰ ਦੇ ਜਿਹੜੇ ਲੋਕ ਵਪਾਰ ਕਰਨਾ ਚਾਹੁੰਦੇ ਹਨ ਜਾਂ ਵਪਾਰ ਕਰ ਰਹੇ ਹਨ ਛੋਟੇ ਵਪਾਰੀ ਉਹ ਵੱਡੇ ਵਪਾਰੀਆਂ ਨਾਲ ਹੁਣ ਹੋਰ ਵੀ ਜ਼ਿਆਦਾ ਜੁੜ ਰਹੇ ਹਨ ਪਹਿਲਾਂ ਤਾਂ ਉਹ ਉਹਨਾਂ ਦੀ ਗਿਣਤੀ ਘਾਟੇ 'ਚ ਸੀ ਪਰ ਹੁਣ ਹੌਲੀ ਹੌਲੀ ਇਹ ਛੋਟੇ ਵਪਾਰੀ ਵੱਡੇ ਵਪਾਰੀਆਂ ਨਾਲ ਜੁੜ ਕੇ ਆਪਣੇ ਰੁਜ਼ਗਾਰ ਨੂੰ ਵਧਾ ਰਹੇ ਹਨ ਅਤੇ ਹੋਰ ਵੀ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਜਿਵੇਂ ਕਿ ਮੈਂ ਤੁਹਾਨੂੰ ਇੱਕ ਉਦਾਹਰਣ ਦੇ ਤੌਰ 'ਤੇ ਇੱਕ ਗੱਲ ਸਮਝਾਉਣੀ ਚਾਹੁੰਦਾ ਹਾਂ ਹੁਣ ਪੰਜਾਬ ਦੇ ਵਿੱਚ ਪਿੱਤਲ ਦਾ ਪਿੱਤਲ ਦੇ ਭਾਂਡਿਆਂ ਦਾ ਚਲਣ ਫਿਰ ਤੋਂ ਚੱਲ ਪਿਆ ਹੈ ਅਤੇ ਹੁਣ ਇੱਕ ਪੀਤਲ ਕਰਕੇ ਕੰਪਨੀ ਹੈ ਵੱਡੀ ਜੋ ਕਿ ਪੰਜਾਬ ਦੇ ਠਠਿਆਰੇ ਲੋਕ ਹਨ ਜੋ ਕਿ ਪਿੱਤਲ ਦੇ ਭਾਂਡੇ ਬਣਾਉਂਦੇ ਹਨ ਅਤੇ ਉਹ ਜਿਹੜੇ ਠਠਿਆਰੇ ਸਮਾਜ ਦੇ ਲੋਕ ਹਨ ਉਹ ਵੱਡੀ ਉਸ ਕੰਪਨੀ ਨੂੰ ਆਪਣੇ ਭਾਂਡੇ ਬਣਾ ਕੇ ਅਤੇ ਵੇਚਦੇ ਹਨ ਤਾਂ ਉਹ ਅਗਾਂਹ ਆਪਣੇ ਵਰਗੇ ਕਸਟਮਰਾਂ ਨੂੰ ਜਾਨੀ ਕਿ ਆਪਣੇ ਵਰਗੇ ਜੋ ਗ੍ਰਾਹਕ ਹਨ ਉਹਨਾਂ ਨੂੰ ਵੇਚ ਦਿੰਦੇ ਹਨ ਅਤੇ ਇਸ ਨਾਲ ਰੁਜ਼ਗਾਰ ਦੀ ਵ੍ਰਿੱਧੀ ਹੋ ਰਹੀ ਹੈ ਜਾਨੀ ਕਿ ਰੁਜ਼ਗਾਰ 'ਚ ਵਾਧਾ ਹੋ ਰਿਹਾ ਹੈ ਅਤੇ ਆਪਣੇ ਪੰਜਾਬ ਦੇ ਛੋਟੇ ਵਪਾਰੀ ਹਨ ਉਹਨਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਅਤੇ ਉਹਨਾਂ ਦੀ ਆਮਦਨ ਵਿੱਚ ਵਾਧਾ ਵੀ ਹੋ ਰਿਹਾ ਹੈ ਅਤੇ ਹੁਣ ਉਹਨਾਂ ਦੇ ਵਿੱਚ ਇੱਕ ਵਪਾਰਕ ਸਾਂਝ ਦੇ ਤੌਰ 'ਤੇ ਬਹੁਤ ਵੱਡੀ ਇੱਕ ਕ੍ਰਾਂਤੀ ਆਉਣੀ ਸ਼ੁਰੂ ਹੋ ਗਈ ਹੈ ਅਤੇ ਧੰਨਵਾਦ ਜੀ